ਭੰਗੜੇ ਦੇ ਕੁਝ ਆਮ ਸਟੈਪ ਤਾੜੀ ਝੂਮਰ ਪਟਾਕਾ ਜੱਫਾ ਡਬਲ ਜੱਫਾ ਖਿੱਚਾਂ ਸੰਮੀ ਵਾਲਾ ਝੂਮਰ ਲੁੱਡੀ ਆਦਿ ਹਨ ਇਨ੍ਹਾਂ ਦੇ ਵਿੱਚੋਂ ਜਿਹੜਾ ਜੱਫਾ ਹੈ ਉਹ ਸਿੰਗਲ ਜੱਫਾ ਵੀ ਪਾਇਆ ਜਾਂਦਾ ਹੈ ਅਤੇ ਡਬਲ ਜੱਫਾ ਵੀ ਪਾਇਆ ਜਾਂਦਾ ਹੈ ਜਿਹੜਾ ਇੱਕ ਝੂਮਰ ਨਾਚ ਆ ਉਹਦੇ ਨਾਲ ਬਾਹਾਂ ਦੀ ਕਸਰਤ ਹੁੰਦੀ ਹੈ ਅਤੇ ਜਿਹੜਾ ਭੰਗੜਾ ਨਾਚ ਆ ਉਹਦੇ ਉਹਦੇ ਨਾਲ ਸਾਡੇ ਜਿਹੜਾ ਹੈਗਾ ਵਾ ਜ਼ੋਰਦਾਰ ਬਹੁਤ ਜ਼ਿਆਦਾ ਤਾਕਤ ਲੱਗਦੀ ਹੈ ਜਿਸ ਕਰਕੇ ਸਾਡੇ ਸੁਭਾਅ ਵਿੱਚ